ਨਮਸ਼ਕਾਰ ਮੇਰਾ ਨਾਮ ਅਮਨ ਹੈ ਅਤੇ ਮੈਂ ਐਮਾਜ਼ੋਨ ਤੋਂ ਇੱਕ ਟੋਪ ਔਡਰ ਕੀਤਾ ਸੀ ਪਰ ਉਹ ਉਸਦਾ ਰੰਗ ਬਿਲਕੁਲ ਉਸ ਤਰ੍ਹਾਂ ਦਾ ਨਹੀਂ ਆਇਆ ਜਿਸ ਤਰ੍ਹਾਂ ਦਾ ਦੇਖ ਕੇ ਔਡਰ ਕੀਤਾ ਗਿਆ ਸੀ ਤਾਂ ਮੇਰੇ ਵੱਲੋਂ ਉਹ ਔਡਰ ਕੈਂਸਲ ਕਰ ਦਿੱਤਾ ਗਿਆ ਸੀ ਜੋ ਕਿ ਚੌਦਾਂ ਦਿਨਾਂ ਵਿੱਚ ਕੈਂਸਲ ਹੋ ਸਕਦਾ ਸੀ ਅਤੇ ਮੈਂ ਪੰਜ ਦਿਨਾਂ ਦੇ ਵਿੱਚ ਵਿੱਚ ਹੀ ਉਸਨੂੰ ਕੈਂਸਲ ਕਰਕੇ ਰਿਟਰਨ ਕਰ ਦਿੱਤਾ ਸੀ ਪਰ ਅੱਜ ਪੰਦਰਾਂ ਦਿਨ ਹੋ ਚੁੱਕੇ ਹਨ ਹਾਲੇ ਤੱਕ ਮੇਰੇ ਕੋਲ ਰਿਫੰਡ ਨਹੀਂ ਆਇਆ ਹੈ ਅਤੇ ਮੈਂ ਮੇਰੇ ਔਡਰ ਨੰਬਰ ਪੰਜ ਸੌ ਇੱਕ ਐਮਾਜ਼ੋਨ ਤੋਂ ਇੱਕ ਟੋਪ ਪੀਲੇ ਰੰਗ ਦਾ ਔਡਰ ਕੀਤਾ ਗਿਆ ਸੀ ਜੋ ਕਿ ਚਾਰ ਸੌ ਅੱਸੀ ਰੁਪਏ ਦਾ ਸੀ ਕਿਰਪਾ ਕਰਕੇ ਮੇਰਾ ਰਿਫੰਡ ਮੈਨੂੰ ਵਾਪਸ ਕੀਤਾ ਜਾਵੇ ਤਾਂ ਜੋ ਮੈਂ ਅੱਗੇ ਹੋਰ ਔਡਰ ਆਪਣੀ ਪਸੰਦੀਦਾ ਚੀਜ਼ ਦਾ ਕਰ ਸਕਾ ਧੰਨਵਾਦ